ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਅਤੇ ਤੁਸੀਂ ਸਵਿੱਗੀ ਤੋਂ ਗੱਲ ਕਰਦੇ ਪਏ ਹੋ ਸਰ ਸਰ ਆਪਣੇ ਘਰ ਕੱਲ੍ਹ ਚੌਵੀਂ ਪੰਜ ਦੋ ਹਜ਼ਾਰ ਚੌਵੀ ਨੂੰ ਆਪਣੇ ਘਰ ਪਾਰਟੀ ਹੈ ਸ਼ਾਮ ਦੀ ਸਰ ਕੁਛ ਮਹਿਮਾਨਾਂ ਨੇ ਆਉਣਾ ਕੁਛ ਦੋਸਤਾਂ ਨੇ ਆਉਣਾ ਅਤੇ ਉਹਨਾਂ ਵਾਸਤੇ ਮੈਂ ਖਾਣਾ ਔਡਰ ਕਰਨਾ ਸੀਗਾ ਸੋ ਸਰ ਆਪਾਂ ਨੂੰ ਥੋੜ੍ਹਾ ਜਿਹਾ ਰਿਆਇਤ ਲਾ ਕੇ ਰੇਟ ਰੇਟ ਦੇ ਵਿੱਚ ਆਪਾਂ ਨੂੰ ਕੁਛ ਸਮਾਨ ਚਾਹੀਦਾ ਸੀਗਾ ਥੋੜ੍ਹਾ ਜਿਹਾ ਰਿਆਇਤ ਲਾ ਦਿਓ ਸਰ ਆਪਾਂ ਨੂੰ ਚਾਲੀ ਨਾਨ ਦਾਲ ਮੱਖਣੀ ਸ਼ਾਹੀ ਪਨੀਰ ਪਨੀਰ ਦੀ ਸਬਜ਼ੀ ਚਾਰ ਪੀਜ਼ੇ ਦੋ ਕਿਲੋ ਗੁਲਾਬ ਜਾਮਣਾ ਸੋ ਇਹ ਹੀ ਚਾ ਇਹ ਹੀ ਚਾਹੀਦਾ ਜੋ ਮੈਂ ਲਿਸਟ ਦੇ ਵਿੱਚ ਲਿਖਾ ਤਾ ਸੋ ਸਰ ਕੱਲ੍ਹ ਸ਼ਾਮ ਨੂੰ ਛੇ ਵਜੇ ਤੱਕ ਆਪਣੇ ਘਰ ਪਹੁੰਚ ਜਾਣਾ ਚਾਹੀਦਾ ਸਰ ਸਰ ਮੈਨੂੰ ਮੇਰੇ ਮਹਿਮਾਨਾਂ ਨੇ ਦੱਸਿਆ ਸੀ ਕੁਝ ਮੇਰੇ ਦੋਸਤਾਂ ਨੇ ਦੱਸਿਆ ਸੀ ਕਹਿੰਦੇ ਵੀ ਸਵਿੱਗੀ ਦੀ ਡਿਲੀਵਰੀ ਬਹੁਤ ਵਧੀਆ ਹੈਗੀ ਸੋ ਇਸ ਕਰਕੇ ਮੈਂ ਖਾਣਾ ਮੰਗਵਾ ਰਿਹਾ ਸੀਗਾ ਇਹ ਅਤੇ ਕੱਲ੍ਹ ਨੂੰ ਸ਼ਾਮ ਨੂੰ ਛੇ ਵਜੇ ਤੱਕ ਜੀ ਪਹੁੰਚਦਾ ਕਰ ਦਿਓ ਆਪਣੇ ਕੋਲ ਅਤੇ ਬਾਕੀ ਮੈਂ ਤੁਹਾਡੇ ਬਾਰੇ ਸੁਣਿਆ ਗਾ ਸਰ ਕਿ ਬਹੁਤ ਵਧੀਆ ਡਿਲੀਵਰੀ ਤੁਸੀਂ ਪਹੁੰਚਾਉਂਦੇ ਹੋ ਟੈਮ 'ਤੇ ਸੋ ਸਰ ਜੇ ਹੋ ਸਕੇ ਤਾਂ ਅਮਰੀਕ ਦੇ ਢਾਬੇ ਤੋਂ ਇਹ ਜੋ ਮੈਂ ਔਡਰ ਕੀਤਾ ਗਾ ਇਹ ਅਮਰੀਕ ਦੇ ਢਾਬੇ ਤੋਂ ਆ ਜਾਵੇ ਤਾਂ ਬਹੁਤ ਵਧੀਆ ਸਰ ਸਰ